ਜਦੋਂ ਕੋਈ ਕੀੜਾ ਮਕੌੜਾ ਡੰਗ ਮਾਰਦਾ ਜਾਂ ਮਧੂ ਮੱਖੀ ਅ ਡੰਗ ਮਾਰਦੀ ਹੈ ਤਾਂ ਉਸ ਸਮੇਂ ਸਮੇਂ ਸਾਡੇ ਪਿੰਡਾਂ ਵਿੱਚ ਕਈ ਮਤਲਬ ਜੋ ਬਜ਼ੁਰਗ ਔਰਤਾਂ ਹੁੰਦੀਆਂ ਨੇ ਜਾਂ ਬਜ਼ੁਰਗ ਹੁੰਦੇ ਨੇ ਉਹ ਉਹਦਾ ਹਥੋਲਾ ਕਰ ਦਿੰਦੇ ਨੇ ਅਤੇ ਹਥੋਲਾ ਕਰਕੇ ਉਹਦਾ ਉਹਦੇ ਸ ਨਾਲ ਸੋਜਸ ਨਹੀਂ ਆਉਂਦੀ ਅਤੇ ਸਾਡੇ ਪਿੰਡਾਂ ਵਿੱਚ ਮਤਲਬ ਕਿ ਕੋਈ ਪੈਟਰੋਲ ਯੂਜ਼ ਕਰ ਲੈਣਾ ਥੋੜ੍ਹਾ ਜਿਹਾ ਅ ਕੋਟਨ 'ਤੇ ਲਾ ਕੇ ਪੈਟਰੋਲ ਲਾ ਲੈਂਦੇ ਨੇ ਉਸ ਨਾਲ ਵੀ ਰਾਹਤ ਮਿਲਦੀ ਹੈ ਅਤੇ ਅੰਬ ਦਾ ਅਚਾਰ ਹੁੰਦਾ ਜਿਹੜਾ ਖੱਟਾ ਉਹ ਵੀ ਲਾ ਲੈਂਦੇ ਨੇ ਉਹਦੇ ਨਾਲ ਵੀ ਮਤਲਬ ਉਹ ਹੁੰਦਾ ਠੀਕ ਹੋ ਜਾਂਦਾ ਅਤੇ ਹ ਪਰ ਇਹਦੇ ਨਾਲ ਠੀਕ ਹੋ ਜਾਂਦਾ ਅੱਜ ਕੱਲ੍ਹ ਤਾਂ ਮਤਲਬ ਇਹੋ ਜਿਹੀਆਂ ਜ਼ਹਿਰੀਲੀਆਂ ਚੀਜਾਂ ਹੋ ਰਹੀਆਂ ਨੇ ਠੀਕ ਨਹੀਂ ਹੁੰਦੇ ਤਾਂ ਮੈਡੀਸਨ ਲੈਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਮੈਡੀਸਨ ਜਾਂ ਇੰਜੈਕਸ਼ਨ ਲਗਾਇਆ ਜਾਂਦਾ ਹੈ ਕਿਉਂ ਕੀੜੇ ਮਕੌੜੇ ਇਹੋ ਜਿਹੇ ਜ਼ਹਿਰੀਲੀਆਂ ਚੀਜ਼ਾਂ ਸੱਪ ਵਗੈਰਾ ਅਤੇ ਬੈਠਦੇ ਨੇ ਤਾਂ ਉਹ ਇਤਨੀ ਇੰਨੀ ਜ਼ਹਿਰੀਲੀਆਂ ਹੋ ਜਾਂਦੀਆਂ ਹਨ ਕਿ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਦਿੰਦੀਆਂ ਨੇ